ਵਿਕਾਸਸ਼ੀਲ ਸੰਸਾਰ ਜੋ ਕਿ ਨਿਰੰਤਰ ਬਦਲ ਰਿਹਾ ਹੈ ਹੁਣ ਪਹਿਲਾਂ ਵਾਲੀਆਂ ਚੀਜ਼ਾਂ ਨਹੀਂ ਰਹੀਆਂ ਅੱਗੇ ਅੱਗੇ ਟੈਕਨੋਲੋਜੀ ਨੇ ਐਨਾ ਵਿਕਾਸ ਕਰ ਲਿਆ ਹੈ ਕਿ ਹੁਣ ਮਨੁੱਖ ਦੀ ਜਗ੍ਹਾ ਰੋਬੋਟ ਕੰਮ ਕਰ ਰਹੇ ਹਨ ਅਤੇ ਰੈਸਟੋਰੈਂਟਾਂ ਵਿੱਚ ਵੀ ਉਹ ਖਾਣਾ ਪਰੋਸ ਰਹੇ ਹਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਦੇਖ ਕੇ ਲੱਗਦਾ ਹੈ ਕਿ ਦੁਨੀਆਂ ਤਾਂ ਸਾਡੀ ਬਹੁਤ ਬਦਲ ਗਈ ਹੈ